ਪੰਜਾਬ ਵਿੱਚ ਸਮਾਜ ਭਲਾਈ ਦੇ ਲਈ ਜੋ ਸਿਧਾਂਤਕ ਫਲਸਫ਼ਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਜਿਸ ਵਿੱਚ ਵੰਡ ਛਕਣ ਦੀ ਉਹਨਾਂ ਨੇ ਸਭ ਤੋਂ ਵੱਡੀ ਆਪਣੇ ਜਿਹੜੇ ਸ਼ਿਸ਼ ਸਨ ਸਿੱਖਾਂ ਨੂੰ ਉਪਦੇਸ਼ ਦਿੱਤਾ ਅਤੇ ਉਸ ਦੇ ਨਾਲ ਬਹੁਤ ਸਾਰੇ ਜੋ ਪੰਜਾਬ ਦੇ ਲੋਕ ਸਿੱਖ ਬਣੇ ਉਹਨਾਂ ਉੱਪਰ ਪ੍ਰਭਾਵ ਪਿਆ ਅਤੇ ਇੱਥੇ ਗਰੀਬੀ ਦੀ ਦਰ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਅਤੇ ਉਹ ਚੀਜ਼ ਦਾ ਅੱਜ ਇੱਕ ਖਾਲਸਾ ਏਡ ਨਾਮ ਦੀ ਸੰਸਥਾ ਵੀ ਸਮਾਜ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਉਹ ਲੋੜਵੰਦਾਂ ਦੀ ਮਦਦ ਕਰਦੀ ਹੈ ਜੰਗ ਵਿੱਚ ਪੀੜਿਤ ਲੋਕਾਂ ਦੀ ਮਦਦ ਕਰਦੀ ਹੈ ਪਾਣੀ ਹੜ੍ਹ ਸੁਨਾਮੀਆਂ ਦੇ ਵਿੱਚ ਜੋ ਲੋਕ ਤਬਾਹ ਹੋ ਜਾਂਦੇ ਹਨ ਉਹਨਾਂ ਦੀ ਘਰੇਲੂ ਮਦਦ ਕਰਕੇ ਉਹਨਾਂ ਨੂੰ ਲੀਹ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਇਸ ਦੇ ਨਾਲ ਸਮਾਜ ਦੇ ਵਿੱਚ ਇੱਕ ਜੋ ਮਨੁੱਖ ਦੀ ਭਲਾਈ ਦੀ ਗੱਲ ਹੈ ਉਸ ਵਿੱਚ ਵਾਧਾ ਹੁੰਦਾ ਹੈ ਅਤੇ ਜੇ ਅਸੀਂ ਗੱਲ ਕਰੀਏ ਕਿ ਇਸ ਸੰਸਥਾ ਦੀ ਦੇਣ ਵਿਸ਼ਵ ਵਿਆਪੀ ਹੈ ਤਾਂ ਇਸ ਦੇ ਨਾਲ ਹਰ ਮਨੁੱਖ ਨੂੰ ਲਾਭ ਪਹੁੰਚ ਰਿਹਾ ਹੈ ਇੱਕ ਬਹੁਤ ਹੀ ਚੰਗੇਰੀ ਗੱਲ ਹੈ